ਪਿਛਲੇ ਸਾਲ ਅਸੀਂ ਵੀਹ ਸੌ ਬਾਈ ਵਿੱਚ ਹੇਮਕੁੰਡ ਸਾਹਿਬ ਦੀ ਯਾਤਰਾ ਕਰੀ ਸੀ ਅਸੀਂ ਪੰਜ ਛੇ ਜਾਣੇ ਸੀ ਸਾਨੂੰ ਨਾ ਬੜਾ ਉੱਥੇ ਵਿਲੱਖਣ ਚੁਣੌਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਾਨੂੰ ਉਸ ਯਾਤਰਾ ਬਾਰੇ ਕੋਈ ਪਹਿਲਾਂ ਤਜਰਬਾ ਨੀ ਸੀ ਅਤੇ ਅਸੀਂ ਜਦ ਦੇਖਿਆ ਉੱਥੇ ਰਸਤੇ ਵਿੱਚ ਜਾ ਰਹੇ ਸੀ ਅਤੇ ਸਾਨੂੰ ਕਿਸੇ ਰੈਸਟੋਰੈਂਟ ਵਗੈਰਾ ਦੀ ਵੀ ਜਾਣਕਾਰੀ ਨਾ ਸੀ ਕਿ ਕਿੱਥੇ ਰਹਿਣਾ ਕਿੱਥੇ ਕਮਰੇ ਲੈਣੇ ਆ ਦੋ ਤਿੰਨ ਸਥਾਨ 'ਤੇ ਅਸੀਂ ਫਿਰ ਜਿਵੇਂ ਗੁਰਦੁਆਰਾ ਸਾਹਿਬ ਸੀ ਅਸੀਂ ਉੱਥੇ ਰਾਤ ਗੁਜ਼ਾਰੀ ਉਸ ਤੋਂ ਬਾਅਦ ਅਸੀਂ ਜਦੋਂ ਸਾਡੀ ਗੱਡੀ ਦਾ ਸਾਨੂੰ ਪੈਟਰੋਲ ਪੰਪਾਂ ਬਾਰੇ ਜਾਣਕਾਰੀ ਨਾ ਸੀਗੀ ਅਤੇ ਗੈਸ ਵਗੈਰਾ ਤ ਮੁੱਕ ਗਈ ਉਹਦੇ ਵਿੱਚ ਅਤੇ ਫ਼ਿਰ ਸਾਨੂੰ ਉਪਰੋਂ ਪਤਾ ਲੱਗਿਆ ਕਿ ਨੀਚੇ ਪੈਟਰੋਲ ਸਸਤਾ ਨੀਚਿਓਂ ਪਵਾ ਲੈਣਾ ਚਾਹੀਦਾ ਸੀ ਉੱਪਰ ਕਾਫੀ ਮਹਿੰਗਾ ਸੀ ਅਤੇ ਭੋਜਨ ਦਾ ਵਿਕਲਪ ਵੀ ਅਸੀਂ ਦੇਖਿਆ ਉੱਥੇ ਸਾਨੂੰ ਖਾਣਾ ਬਹੁਤ ਮਹਿੰਗਾ ਪੈ ਰਿਹਾ ਸੀਗਾ ਕਾਫੀ ਮਹਿੰਗਾਈ ਸੀ ਦੁਕਾਨਦਾਰ ਕਾਫੀ ਵੱਧ ਪੈਸੇ ਵਸੂਲ ਰਹੇ ਸੀ ਕਈ ਥਾਵਾਂ 'ਤੇ ਤਾਂ ਅਸੀਂ ਫਿਰ ਭੋਜਨ ਜਿਹੜਾ ਸੀਗਾ ਮਹਿੰਗਾ ਹੋਣ ਕਰਕੇ ਗੁਰਦੁਆਰਾ ਸਾਹਿਬ ਵਿੱਚੇ ਲੰਗਰ ਵਗੈਰਾ ਹੀ ਛਕਿਆ ਇਸ ਤਰ੍ਹਾਂ ਅਸੀਂ ਬਿਨਾਂ ਤਜਰਬੇ ਤੋਂ ਜਦੋਂ ਗਏ ਸਾਨੂੰ ਬੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਸਾਡਾ ਤਜਰਬਾ ਜਿਹੜਾ ਸੀਗਾ ਬੜਾ ਮੁਸ਼ਕਿਲ ਭਰਿਆ ਰਿਹਾ